ਹੈਲੋ ਪੰਜਾਬ ਤੋਂ ਗੱਲ ਕਰ ਰਹੇ ਹੋ ਤੁਸੀਂ ਅਸੀਂ ਨਾ ਪੰਜਾਬ 'ਚ ਨਵੇਂ ਰਹਿਣ ਆਏ ਹਾਂ ਕੀ ਤੁਸੀਂ ਸਾਨੂੰ ਹਿਸਟੋਰੀਕਲ ਪਲੇਸਿਸ ਬਾਰੇ ਦੱਸ ਸਕਦੇ ਹੋ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਸਾਨੂੰ ਅਜੇ ਥੋੜ੍ਹੇ ਹੀ ਦਿਨ ਹੋਏ ਨੇਗੇ ਅਤੇ ਅਸੀਂ ਨਾ ਪੰਜਾਬ ਦੇ ਹਿਸਟੋਰੀਕਲ ਪਲੇਸਿਸ ਬਾਰੇ ਜਾਣਕਾਰੀ ਲੈਣੀ ਹੈ ਹਾਂਜੀ ਹਾਂਜੀ ਹਾਂ ਹਾਂਜੀ ਠੀਕ ਹੈ ਠੀਕ ਹੈ ਥੈਂਕ ਯੂ